ਚਿੱਤਰਕਾਰੀ ਮੇਰਾ ਬਚਪਨ ਦਾ ਬਹੁਤ ਹੀ ਵੱਡਾ ਸ਼ੌਂਕ ਸੀ ਜਿਸ ਨੂੰ ਮੈਂ ਜਨਮ ਤੋਂ ਬਾਅਦ ਤਿੰਨ ਚਾਰ ਸਾਲ ਤੋਂ ਬਾਅਦ ਹੀ ਇਸ ਨੂੰ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗ ਗਿਆ ਸੀ ਇਸ ਦੇ ਵਿੱਚ ਬਹੁਤ ਹੀ ਵਧੀਆ ਚੀਜ਼ਾਂ ਕੀਤੀਆਂ ਜਾ ਸਕਦੀਆਂ ਹਨ ਅਤੇ ਇਸ ਦੇ ਵਿੱਚ ਮੈਂ ਜਿਹੜਾ ਬੰਦਾ ਅੱਜ ਦੀ ਤਰੀਕ ਦੇ ਵਿੱਚ ਇਸ ਨੂੰ ਨਵਾਂ ਸ਼ੁਰੂ ਕਰ ਰਿਹਾ ਹੈ ਮੈਂ ਉਸਨੂੰ ਇਹ ਸਲਾਹ ਦੇਣਾ ਚਾਹਾਂਗਾ ਕਿ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡਾ ਜੋ ਕੋਈ ਵੀ ਕੰਮ ਸਿੱਖਣ ਦੇ ਲਈ ਸਹਾਇਕ ਹੁੰਦਾ ਹੈ ਉਹ ਹੁੰਦਾ ਹੈ ਇੰਟਰਨੈਟ ਉਸ ਨੂੰ ਇੰਟਰਨੈਟ ਦੇ ਉੱਤੇ ਜਾ ਕੇ ਬਹੁਤ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਹਨ ਸਾਡੇ ਸਮੇਂ ਦੇ ਵਿੱਚ ਤਾਂ ਬਹੁਤ ਘੱਟ ਇਹ ਚੀਜ਼ਾਂ ਸੀਗੀਆਂ ਪਰ ਜੋ ਅੱਜ ਦੀ ਤਾਰੀਕ ਦੇ ਵਿੱਚ ਬੰਦਾ ਨਵੀਂ ਚਿੱਤਰਕਾਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਉਸਨੂੰ ਸਿਖਣਾ ਚਾਹੁੰਦਾ ਹੈ ਉਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜੋ ਇੰਟਰਨੈਟ ਦਾ ਹੈ ਉਹ ਕੋਈ ਵੀ ਚੀਜ਼ ਦਾ ਨਹੀਂ ਹੋ ਸਕਦਾ ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਜ ਦੀ ਤਰੀਕ ਦੇ ਵਿੱਚ ਜੋ ਵੀ ਕੋਈ ਚਿੱਤਰਕਾਰੀ ਹੈ ਉਸਨੂੰ ਆਪਾਂ ਇੱਕ ਨਵੇਂ ਨਵੇਂ ਤਰ੍ਹਾਂ ਦੇ ਜੋ ਪੇਂਟ ਪੇਂਟ ਕਲਰ ਆ ਗਏ ਹਨ ਜਿਸ ਨੂੰ ਅਸੀਂ ਵਾਟਰ ਕਲਰ ਵੀ ਕਹਿੰਦੇ ਹਾਂ ਹੋਰ ਵੀ ਕਈ ਚੀਜ਼ਾਂ ਆ ਗਈਆਂ ਹਨ ਜੋ ਉਹ ਪਹਿਲੇ ਜ਼ਮਾਨੇ ਦੇ ਵਿੱਚ ਨਹੀਂ ਹੁੰਦੀਆਂ ਸੀ ਉਹ ਇੱਕ ਚਿੱਤਰ ਨੂੰ ਬਹੁਤ ਹੀ ਜ਼ਿਆਦਾ ਖੂਬਸੂਰਤ ਤੋਂ ਅੱਗੇ ਖੂਬਸੂਰਤ ਬਣਾ ਸਕਦੇ ਹਨ